ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਏ ਪੀ ਨਿਊਜ਼ ਤੋਂ ਗੱਲ ਕਰ ਰਿਹਾ ਮੈਂ ਇਸ ਟਾਈਮ 'ਤੇ ਭਾਅ ਜੀ ਪੰਜਾਬ ਆਇਆ ਹੋਇਆ ਅਤੇ ਤੁਸੀਂ ਕੀ ਮੈਨੂੰ ਆਪਣੇ ਇੱਥੇ ਜਿਹੜੇ ਤਿਉਹਾਰ ਹੁੰਦੇ ਉਹਦੇ ਬਾਰੇ ਕੁਛ ਦੱਸ ਸਕਦੇ ਜੇ ਅੱਛਾ ਜੀ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ